ਮੈਂ ਫੇਸਬੁੱਕ ਜਾਂ ਇੰਸਟਾਗਰਾਮ ਵਰਗੇ ਸੋਸ਼ਲ ਮੀਡੀਆ ਪਲੈਟਫੋਰਮ ਦੀ ਵਰਤੋਂ ਕੀਤੀ ਹੈ ਇੰਸਟਾਗਰਾਮ ਦੇ ਨਾਲ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਦੇ ਨੇ ਅਤੇ ਫੇਸਬੁੱਕ ਰਾਹੀਂ ਵੀ ਲੋਕ ਆਪਣੇ ਦੋਸਤਾਂ ਨਾਲ ਗੱਲ ਕਰ ਸਕਦੇ ਨੇ ਯਾਂ ਉਹਨਾਂ ਨੂੰ ਮੈਸੇਜ ਕਰ ਸਕਦੇ ਨੇ ਫੇਸਬੁੱਕ ਦੇ ਅੰਦਰ ਲੋਕ ਇਹ ਵੀ ਪੋਸਟ ਕਰ ਸਕਦੇ ਨੇ ਵੀ ਉਹ ਕਿੱਥੇ ਕਿੱਥੇ ਨੇ ਅਤੇ ਉਹ ਕਿੱਥੇ ਜਾ ਰਹੇ ਨੇ ਇਸ ਦੇ ਨਾਲ ਬਾਕੀਆਂ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਉਹ ਕਿੱਥੇ ਟਰੈਵਲ ਕਰ ਰਹੇ ਨੇ ਇੰਸਟਾਗਰਾਮ ਦੇ ਅੰਦਰ ਲੋਕ ਆਪਣੀ ਫੋਟੋਸ ਪੋਸਟ ਕਰ ਸਕਦੇ ਹਨ ਅਤੇ ਉਹਨਾਂ ਦੇ ਦੋਸਤ ਉਸ ਪਿਕਚਰਸ ਨੂੰ ਲਾਈਕ ਕਰ ਸਕਦੇ ਨੇ ਕਾਫੀ ਬਿਜਨਸਿਸ ਵੀ ਇਸਟਾਗਰਾਮ ਅਤੇ ਫੇਸਬੁੱਕ ਦੀ ਵਰਤੋਂ ਕਰਦੇ ਨੇ ਜਿਹੜੇ ਵੀ ਸਮੋਲ ਬਿਜਨੇਸਿਸ ਨੇ ਉਹ ਆਪਣੀ ਫੋਟੋਜ਼ ਆਪਣੇ ਪ੍ਰੋਡਕਟਸ ਦੀ ਪਿਕਚਰਸ ਇੰਸਟਾਗਰਾਮ 'ਤੇ ਪਾ ਦਿੰਦੇ ਨੇ ਜਿਹਨਾਂ ਦੇ ਨਾਲ ਉਹ ਕਾਫੀ ਜ਼ਿਆਦਾ ਕਸਟਮਰਸ ਨੂੰ ਆਪਣੇ ਪ੍ਰੋਡਕਟ ਬਾਰੇ ਦੱਸ ਸਕਦੇ ਨੇ ਇਹ ਇੱਕ ਬਹੁਤ ਅੱਛਾ ਜ਼ਰੀਆ ਹੈ ਮਾਰਕੀਟਿੰਗ ਕਰਨ ਦਾ ਜਿਹਦੇ ਨਾਲ ਜਿਹੜੇ ਸਮੋਲ ਬਿਜਨਸਿਸ ਨੇ ਉਹਨਾਂ ਨੂੰ ਕਾਫੀ ਫਾਇਦਾ ਹੁੰਦਾ ਹੈ ਕਾਫੀ ਬੜੇ ਬਿਜ਼ਨੇਸਿਸ ਵੀ ਇੰਸਟਾਗਰਾਮ ਅਤੇ ਫੇਸਬੁੱਕ ਦੀ ਵਰਤੋਂ ਕਰਦੇ ਹਨ ਜਿਹਨਾਂ ਦੇ ਨਾਲ ਉਹਨਾਂ ਨੂੰ ਨਵੇਂ ਕਸਟਮਰਸ ਮਿਲਦੇ ਨੇ ਅਤੇ ਉਹ ਸਾਰੇ ਕਸਟਮਰਸ ਉਹਨਾਂ ਦੇ ਪ੍ਰੋਡਕਟਸ ਲੈ ਲੈਂਦੇ ਨੇ ਇਸ ਦੇ ਬਾਵਜੂਦ ਕੁਝ ਐਸੇ ਕਲਾਕਾਰ ਵੀ ਹਨ ਜੋ ਇੰਸਟਾਗਰਾਮ ਅਤੇ ਫੇਸਬੁੱਕ ਦੀ ਵਰਤੋਂ ਕਰਕੇ ਆਪਣੀ ਔਡੀਅੰਸਿਸ ਦੀ ਜਿਹੜੀ ਰੀਚ ਹੈ ਉਹਨੂੰ ਇੰਕਰੀਸ ਕਰ ਦਿੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਕਿਹੜੇ ਕੌਂਸਰਟਸ ਨੇ ਉਹ ਜਿਹੜੇ ਨਵੇਂ ਅਟੈਂਡ ਕਰਨਗੇ ਇਸ ਸਭ ਦੇ ਨਾਲ ਇੰਸਟਾਗਰਾਮ ਅਤੇ ਫੇਸਬੁੱਕ ਦੀ ਕਾਫੀ ਰੀਚ ਇਨਕਰੀਜ ਹੋ ਜਾਂਦੀ ਹੈ ਅਤੇ ਇਹਦੇ ਕਰਕੇ ਲੋਕ ਅਪਡੇਟਿਡ ਰਹਿੰਦੇ ਨੇ ਵੀ ਦੁਨੀਆਂ ਦੇ ਵਿੱਚ ਵੀ ਕੀ ਹੋ ਰਿਹਾ ਹੈ ਜਿਹਦੇ ਨਾਲ ਲੋਕਾਂ ਨੂੰ ਸਿਰਫ ਨਿਊਜ਼ ਦੇਖਣ ਦੀ ਲੋੜ ਨਹੀਂ ਪੈਂਦੀ ਅਤੇ ਇੰਸਟਾਗਰਾਮ ਅਤੇ ਫੇਸਬੁੱਕ ਕਾਫੀ ਯੂਜ਼ਫੁਲ ਹੈ ਇਹ ਪਤਾ ਕਰਨ ਵਾਸਤੇ ਵੀ ਜਿਹੜੀ ਦੁਨੀਆਂ ਹੈ ਉਹਦੇ ਅੰਦਰ ਕੀ ਹੋ ਰਿਹਾ ਹੈ ਜਾਂ ਉਹਨਾਂ ਦੇ ਜਿਹੜੇ ਆਸ ਪਾਸ ਲੋ ਆਸ ਪਾਸ ਵਾਲੇ ਲੋਕ ਹੈ ਉਹ ਕੀ ਕਰ ਰਹੇ